ਹਾਂਜੀ ਅਸੀਂ ਸੋਚਦੇ ਹਾਂ ਕਿ ਕੁਝ ਲੋਕ ਰਾਜਨੀਤਿਕ ਤਣਾਅ ਪੈਦਾ ਕਰਨ ਵਿੱਚ ਧਰਮ ਦਾ ਧਰਮ ਦੀ ਆੜ ਲੈਂਦੇ ਹਨ ਅਤੇ ਧਰਮ ਨੂੰ ਬਦਨਾਮ ਕਰਦੇ ਹਨ ਕੁਝ ਸਮਾਜ ਦੇ ਵਿੱਚ ਪੋਲੀਟੀਕਲ ਬੰਦੇ ਅਜਿਹੇ ਹੁੰਦੇ ਹਨ ਜਿਹੜੇ ਕਿ ਧਰਮ ਦੀ ਆੜ ਲੈ ਕੇ ਵੋਟਾਂ ਲੈਂਦੇ ਹਨ ਫਿਰ ਧਰਮ ਦਾ ਇਸਤੇਮਾਲ ਕਰਕੇ ਉਸ ਨੂੰ ਦਾਗੋ ਦਾਗ ਕਰਕੇ ਆਪਣਾ ਰਾਜਨੀਤਿਕ ਕਰੀਅਰ ਬਣਾਉਂਦੇ ਹਨ